ਭੰਗੜੇ ਦੀ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਇਹ ਇੱਕ ਇਹੋ ਜਿਹਾ ਤਿਓ ਤਿਓਹਾਰ ਜਾਂ ਡਾਂਸ ਹੈਗਾ ਜਿਸ ਨੂੰ ਪੂਰੇ ਜੋਰ ਸ਼ੋਰ ਨਾਲ ਨੌਜਵਾਨ ਮਨਾਉਂਦੇ ਹਨ ਜ਼ਿਆਦਾਤਰ ਇਸਨੂੰ ਹਰੇਕ ਤਿਓਹਾਰ ਜਾਂ ਫ਼ੰਕਸ਼ਨ ਕੋਲੇਜ ਸਕੂਲ ਕੋਲੇਜ ਦੇ ਫ਼ੰਕਸ਼ਨ ਵਿੱਚ ਜ਼ਰੂਰੀ ਮਨਾਇਆ ਜਾਂਦਾ ਹੈ ਸਾਡੇ ਕੋਲੇਜ ਅੰਦਰ ਇਹ ਪੰਜਾਬ ਡੇਅ ਦੇ ਦਿਨ 'ਤੇ ਇਸਨੂੰ ਮਨਾਇਆ ਗਿਆ ਸੀ ਅਤੇ ਇਹਦੇ ਵਿੱਚ ਮੁੰਡੇ ਕੁੜੀਆਂ ਦੋਵਾਂ ਨੇ ਭਾਗ ਲਿੱਤਾ ਸੀ ਅਤੇ ਦੋਵਾਂ ਨੇ ਹੀ ਬੜੀ ਜੋਰ ਸ਼ੋਰ ਨਾਲ ਇਸਨੂੰ ਪਰਫੋਮ ਕੀਤਾ ਸੀ ਅਤੇ ਪੂਰੇ ਟੀਚਰਸ ਨੇ ਇਹਨੂੰ ਐਪਰੀਸ਼ੀਏਟ ਕੀਤਾ ਸੀ ਕਿ ਤੁਸੀਂ ਬਹੁਤ ਵਧੀਆ ਪਰਫੋਮ ਕੀਤਾ ਹੈ ਇਹੋ ਜਿਹੇ ਨੌਜਵਾਨਾਂ ਨੂੰ ਵੇਖ ਕੇ ਸਾਡੇ ਵੀ ਮਨ ਕਰਦਾ ਕਿ ਅਸੀਂ ਵੀ ਭੰਗੜੇ ਵਿੱਚ ਹਿੱਸਾ ਲਈਏ ਅਤੇ ਸਾਡੇ ਜੋ ਬਜ਼ੁਰਗ ਨੇ ਸਾਡੇ ਜੋ ਵੱਡੇ ਨੇ ਉਨ੍ਹਾਂ ਨੂੰ ਵੇਖ ਕੇ ਵੀ ਅੱਛਾ ਲੱਗਦਾ ਕਿ ਭੰਗੜੇ ਨੂੰ ਅੱਜ ਵੀ ਪੂਰੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਕਲਚਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈਗਾ ਹੈ ਇਸਨੂੰ ਹਰ ਇੱਕ ਤਿਓਹਾਰ ਮਨਾਉਣਾ ਚਾਹੀਦਾ ਹੈ ਚਾਹੀਦਾ ਹੈ ਜਦੋਂ ਵੀ ਸਾਡੇ ਕੋ ਕੋਲੇਜ ਜਾਂ ਸਕੂਲ ਵਿੱਚ ਫ਼ੰਕਸ਼ਨ ਹੁੰਦਾ ਹੈ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਾਂ ਕਿ ਸਾਨੂੰ ਭੰਗੜਾ ਵੇਖਣ ਨੂੰ ਮਿਲੇਗਾ ਅਸੀਂ ਵੀ ਪੂਰਾ ਇੰਟ੍ਰਸਟ ਨਾਲ ਵੇਖਦੇ ਹਾਂ ਸਾਨੂੰ ਖਾਣ ਪੀਣ ਨੂੰ ਵੀ ਮਿਲਦਾ ਹੈ ਕਿਉਂਕਿ ਭੰਗੜੇ ਦੌਰਾਨ ਇੱਕ ਬਹੁਤ ਹੀ ਵਧੀਆ ਇੱਕ ਮਾਹੌਲ ਬਣਦਾ ਹੈ ਕੋਲੇਜ ਦੇ ਅੰਦਰ ਜਿਸ ਕਰਕੇ ਹਰੇਕ ਬੱਚਾ ਖੁਸ਼ ਹੁੰਦਾ ਹੈ ਕੀ ਕੀ ਅੱਜ ਇਹ ਖਾਸ ਦਿਨ ਹੈ ਅਤੇ ਸਾਡੇ ਤਿਓਹਾਰਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕੀ ਆਉਣ ਵਾਲੇ ਸਮੇਂ ਅੰਦਰ ਵੀ ਭੰਗੜੇ ਦੀ ਇੰਪੋਰਟੈਂਸ ਐਵੇਂ ਹੀ ਰਹੇਗੀ ਅਤੇ ਅਸੀਂ ਐਵੇਂ ਹੀ ਇਹਨੂੰ ਪੂਰਾ ਆਪਾਂ ਚੰਗੀ ਤਰ੍ਹਾਂ ਮਨਾਵਾਂਗੇ